ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਕੀ ਸੇਵਾ ਕਰ ਸਕਦੇ ਤੁਹਾਡੀ ਕਿਹੜੀ ਜਗ੍ਹਾ ਤੋਂ ਓਕੇ ਕੋਆਲਟੀ ਵੀ ਵਧੀਆ ਮਿਲੂਗੀ ਫੂਡ ਵੀ ਅੱਛੀ ਕੋਆਲਟੀ ਦਾ ਮਿਲੂਗਾ

ਨਹੀਂ ਨਹੀਂ ਸਰ ਜੇ ਕੋਈ ਇੱਦਾਂ ਦੀ ਗੱਲ ਹੋਈ ਤਾਂ ਅਸੀਂ ਕੋਈ ਵੀ ਪੈਸਾ ਨੀ ਲਵਾਂਗੇ ਤੁਹਾਡੇ ਤੋਂ ਅਸੀਂ ਜੋ ਵੀ ਦੇ ਕੇ ਜਾਵਾਂਗੇ ਕੋਈ ਐਹ ਚੱਕਰ ਨੀ ਤੁਸੀਂ ਬਾਕੀ ਸਾਡੀ ਇਲਾਕੇ 'ਚ ਪੁੱਛ ਲਿਓ ਨਾਮ ਵੀ ਹੈਗੇ ਆ ਅਮਨ ਕੈਟਰਿੰਗ ਵਾਲੇ

ਕੋਈ ਗੱਲ ਨਹੀਂ ਸਰ ਨਹੀਂ ਨਹੀਂ ਕੋਈ ਗੱਲ ਨੀ ਕੋਆਲਟੀ ਵਧੀਆ ਐਨ ਫੁੱਲ ਹੋਊਗੀ ਅਤੇ ਆਪਾਂ ਕੀ ਕੀ ਵਿੱਚ ਥਾਲੀ ਦੇ ਕੀ ਐਟਮ ਪੁਆਣੀ

ਜੀ ਓਕੇ ਜੀ ਕੁਛ ਮਿੱਠਾ ਓਕੇ ਜੀ ਓਕੇ ਓਕੇ ਸਰ ਓਕੇ ਠੀਕ ਹੈ ਕਦੋਂ ਚਾਹੀਦੇ ਤੁਹਾਨੂੰ ਇਹ ਠੀਕ ਹੈ ਜੀ ਠੀਕ ਹੈ ਚਲੋ ਅਸੀਂ ਤੁਹਾਡਾ ਔਡਰ ਲਿਆ ਜੀ ਅਤੇ ਤੋਹਾਨੂੰ ਕੱਲ੍ਹ ਨੂੰ ਕਾਲ ਕਰ ਲਵਾਂਗੇ ਇੱਕ ਵਾਰ ਠੀਕ ਹੈ ਸਰ ਓਕੇ ਜੀ ਧੰਨਵਾਦ ਥੈਂਕ ਯੂ ਥੈਂਕ ਯੂ